ਮੈਂ ਨਵਾਸ਼ਹਿਰ ਸਹਿਰ ਵਿੱਚ ਰਹਿੰਦੀ ਹਾਂ ਇੱਥੇ ਸ਼ਹੀਦ ਭਗਤ ਸਿੰਘ ਦੇ ਨਾਮ ਦੇ ਨਾਲ਼ ਬਹੁਤ ਸਾਰੇ ਚੈਰੀਟੇਬਲ ਸੰਸਥਾਵਾਂ ਬਣਾਈਆਂ ਹਨ ਜਿਵੇਂ ਕਿ ਇਹ ਜਿਹੜੇ ਬੱਚੇ ਪੜ੍ਹ ਲਿਖ ਨਹੀਂ ਸਕਦੇ ਹੈ ਮਤਲਬ ਉਹਨਾਂ ਦੇ ਲਈ ਪੜ੍ਹਨ ਦੂਰ ਜਾ ਨਹੀਂ ਸਕਦੇ ਉਹਨਾਂ ਦੇ ਲਈ ਮਤਲਬ ਪਿੰਡ ਦੇ ਵਿੱਚ ਹੀ ਸਕੂਲ ਬਣਾਇਆ ਹੋਇਆ ਜਿਹੜੇ ਬੱਚੇ ਫ਼ੀਸ ਨਹੀਂ ਦੇ ਸਕਦੇ ਉਹਨਾਂ ਦੇ ਲਈ ਮਤਲਬ ਫ਼ੀਸ ਮੁਫ਼ਤ ਕੀਤੀ ਮਤਲਬ ਕੀਤਾ ਗਿਆ ਹੈ ਅਤੇ ਜਿਹੜੇ ਬੱਚੇ ਜਿਹੜੇ ਪਰਿਵਾਰ ਦੇ ਲੋਕ ਮਤਲਬ ਹੈ ਮਤਲਬ ਸਿਹਤ ਦੇ ਲਈ ਇਹ ਰੀਲੇਟਿਡ ਬੀਮਾਰ ਹਨ ਅਤੇ ਦਵਾ ਵਗੈਰਾ ਨਹੀਂ ਖਵਾ ਸਕਦੇ ਹਨ ਉਹ ਉਹਨਾਂ ਦੇ ਲਈ ਮਤਲਬ ਫ਼ਰੀ ਮੁਫ਼ਤ ਸੇਵਾਵਾਂ ਦਿੱਤੀਆਂ ਗਈਆ ਹਨ ਅਤੇ ਉਹ ਜਿਹੜੇ ਮਤਲਬ ਰਹਿਣ ਮਤਲਬ ਮਤਲਬ ਰਹਿਣ ਦੇ ਲਈ ਘਰ ਨਹੀਂ ਹੈ ਉਹਨਾਂ ਦੇ ਲਈ ਮਤਲਬ ਘਰ ਬਣਾਏ ਹੋਏ ਹਨ ਮਤਲਬ ਇੱਕ ਇੱਕ ਰੂਮ ਹੈ ਸਾਰਿਆਂ ਦੇ ਲਈ ਬਣਾਏ ਗਏ ਹਨ